ਹੈਲੋ ਸਾਨੂੰ ਤਰਨ ਤਾਰਨ ਜ਼ਿਲ੍ਹੇ ਵਿੱਚ ਬਹੁਤ ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਸਾਨੂੰ ਏ ਜਿਵੇਂ ਕਿ ਸਾਨੂੰ ਇੱਦਾਂ ਮਤਲਬ ਕਿ ਗਲੀਆਂ ਵੀ ਬਹੁਤ ਗੰਦੀਆਂ ਹਨ ਅਤੇ ਇਹ ਇਹਦੇ ਵਿੱਚ ਲੰਘਣ ਨੂੰ ਕੋਈ ਵੀ ਸ ਰਾ ਸਾਧਨ ਨਹੀਂ ਹੁੰਦਾ ਵੀ ਜਿਵੇਂ ਕਿ ਨਾਲੀਆਂ ਦਾ ਪਾਣੀ ਵੀ ਗਲੀਆਂ ਦੇ ਵਿੱਚ ਹੀ ਬਹੁਤ ਹੁੰਦਾ ਹੈ ਕਿ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਸਾਡੀਆਂ ਗਲੀਆਂ ਵੀ ਬਣਾਈਆਂ ਜਾਣ ਅਤੇ ਦੂਸਰੀ ਗੱਲ ਇਹ ਕਿ ਹੋਸਪਿਟਲ ਵਿੱਚ ਵੀ ਕੋਈ ਸਾਨੂੰ ਮਤਲਬ ਕਿ ਜ ਵਧੀਆ ਚੀਜ਼ ਪ੍ਰਾਪਤ ਨਹੀਂ ਹੁੰਦੀ ਜਿਵੇਂ ਕਿ ਸਾਨੂੰ ਸਹੂਲਤਾਂ ਨਹੀਂ ਮਿਲਦੀਆਂ ਜਿਵੇਂ ਕਿ ਉੱਥੇ ਵੱਡੀਆਂ ਮਸ਼ੀਨਾਂ ਨਹੀਂ ਹਨ ਐਕਸਰਾ ਵਗੈਰਾ ਨਹੀਂ ਹੋਇਆ ਕਾ ਕੀਤਾ ਜਾਂਦਾ ਐੱਮ ਆਰ ਵੀ ਉੱਥੇ ਨਹੀਂ ਹੁੰਦੀ ਵੀ ਇਸ ਤੁਹਾਨੂੰ ਉੱਥੇ ਵੀ ਸਰਕਾਰੀ ਸਹੂਲਤਾਂ ਚਾਹੀਦੀਆਂ ਹਨ ਅਤੇ ਵਧੀਆ ਜਿਵੇਂ ਕਿ ਇਲਾਜ ਹੋ ਸਕੇ ਇਹਦੇ ਬਾਰੇ ਇਸ ਵਧੀਆ ਇਲਾਜ ਕਰਨ ਲਈ ਸਾਨੂੰ ਸ਼ਹਿਰ ਜਾਣਾ ਪੈਂਦਾ ਹੈ ਅਤੇ ਸਾਨੂੰ ਬਹੁਤ ਹੀ ਮੁਸ਼ਕਲ ਆਉਂਦੀ ਹੈ ਅਤੇ ਟਰੈਫਿਕ ਵੀ ਸਾਨੂੰ ਟ੍ਰੈਫਿਕ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਇਸ ਤੋਂ ਇਲਾਵਾ